ਸੌਲ੍ਹਾਂ ਜੂਨ ਉੱਨੀ ਸੌ ਬਾਨਵੇਂ ਛੇ ਅਕਤੂਬਰ ਦੋ ਹਜ਼ਾਰ ਪੰਜ ਦਸ ਮਾਰਚ ਦੋ ਹਜ਼ਾਰ ਬਾਈ ਛੇ ਜਨਵਰੀ ਦੋ ਹਜ਼ਾਰ ਬਾਰ੍ਹਾਂ ਗਿਆਰ੍ਹਾਂ ਫਰਵਰੀ ਦੋ ਹਜ਼ਾਰ ਚੌਵੀ